ਪੰਜਾਬ ਵਿੱਚ ਖ਼ਾਸ ਕਰ ਬਸੰਤ ਪੰਚਮੀ ਸਮੇਂ ਪੀਲੇ ਪਕਵਾਨ ਬਣਾਉਣ ਦਾ ਦੀ ਪਰੰਪਰਾ ਹੈ ਅਤੇ ਪੀਲੀਆ ਚੀਜ਼ਾਂ ਵਿੱਚ ਚੋਲ ਅ ਪੀਲੇ ਰੰਗ ਦੇ ਚੌਲ ਜਾਂ ਬੇਸਣ ਦਾ ਹਲਵਾ ਪੀਲੇ ਰੰਗ ਦੇ ਚੋ ਮਿੱਠੇ ਮਿੱਠੇ ਚੋਲ ਜਾਂ ਪੀਲੇ ਰੰਗ ਦੀ ਮੱਕੀ ਦੀ ਰੋਟੀ ਦਾ ਬਣਾਉਣ ਦਾ ਰਿਵਾਜ ਹੈ ਇਸ ਤੋਂ ਇਲਾਵਾ ਲੋਹੜੀ ਇਸ ਵਿੱਚ ਅਗਲੇ ਦਿਨ ਸੰਗਰਾਂਦ ਹੁੰਦੀ ਹੈ ਅਤੇ ਉਸ ਦਿਨ ਖੀਰ ਬਣਾਉਣ ਦਾ ਵਿਸ਼ੇਸ਼ ਤੌਰ 'ਤੇ ਰਿਵਾਜ ਹੈ ਅੰਧ ਵਿਸ਼ਵਾਸਾਂ ਵਿੱਚ ਇਹ ਵਿਸ਼ਵਾਸ ਹੈ ਕਿ ਕਾਰਸੀ ਮੌਕੇ ਦਿਨ ਚੌਲ ਨਹੀਂ ਖਾਣੇ ਚਾਹੀਦੇ ਇਹ ਇੱਕ ਬਹੁਤ ਵੱਡਾ ਅੰਧ ਵਿਸ਼ਵਾਸ ਆਮ ਤੌਰ 'ਤੇ ਪਾਇਆ ਜਾਂਦਾ ਹੈ ਕਿ ਕਾਰਸੀ ਦੇ ਦਿਨ ਤੁਸੀਂ ਚੋਲ ਚੋਲਾਂ ਦਾ ਪਕਵਾਨ ਨਹੀਂ ਬਣਾਉਣਾ